ਕਿਸੇ ਵੀ ਪ੍ਰਾਂਤ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਵਪਾਰ ਜਿਹੜਾ ਹੈਗਾ ਉਹ ਸਥਾਨਕ ਭਾਈਚਾਰੇ ਜਾਂ ਸਮਾਜ ਦੇ ਨਾਲ ਸਮਾਜ ਨੂੰ ਨਾਲ ਲੈ ਕੇ ਚੱਲਿਆਂ ਬਗੈਰ ਨਹੀਂ ਕੀਤਾ ਜਾ ਸਕਦਾ ਜਿੱਦਾਂ ਕਿ ਸਾਡੇ ਇੱਥੇ ਲੋਕਲ ਜਲੰਧਰ ਦੇ ਵਿੱਚ ਲੈਦਰ ਦੀ ਇੰਡਸਟਰੀ ਬਹੁਤ ਹੀ ਮਸ਼ਹੂਰ ਹੈਗੀ ਹੈ ਉਹਦੇ ਵਾਸਤੇ ਕੀ ਹੈਗਾ ਜਿਹੜੇ ਆਪਣੇ ਪਸ਼ੂ ਹੈਗੇ ਨੇ ਉਹਨਾਂ ਦੇ ਮਰਨ ਤੋਂ ਬਾਅਦ ਉਹਨਾਂ ਦੀ ਜਿਹੜੀ ਖੱਲ੍ਹ ਉਤਾਰ ਕੇ ਉਹਨਾਂ ਨੂੰ ਜਿਹੜਾ ਹੈ ਪ੍ਰੋਸੈਸ ਕੀਤਾ ਜਾਂਦਾ ਹੈਗਾ ਇਸ ਪ੍ਰੋਸੈਸਿੰਗ ਤੋਂ ਬਾਅਦ ਕੀ ਹੈਗਾ ਜਿੰਨੇ ਵੀ ਕੈਮੀਕਲ ਯੂਜ ਕੀਤੇ ਜਾਂਦੇ ਹੈਗੇ ਨੇ ਬਾਅਦ ਵਿੱਚੋਂ ਪਹਿਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਉਹ ਪਾਣੀ ਜਿਹੜਾ ਵੇਸਟ ਵਾਟਰ ਹੈਗਾ ਉਹਨੂੰ ਸਿੱਧਾ ਨਹਿਰਾਂ ਦੇ ਵਿੱਚ ਡਿਸਪੋਜ ਆਫ ਕਰ ਦਿੰਦੇ ਸੀਗੇ ਫਿਰ ਸਥਾਨਕ ਲੋਕਾਂ ਨੇ ਉਹਦੇ ਅਗੇਨਸ ਜਿਹੜਾ ਹੈਗਾ ਬੋਲਣਾ ਸ਼ੁਰੂ ਕੀਤਾ ਵੀ ਵਾਤਾਵਰਨ ਜਿਹੜਾ ਹੈਗਾ ਦੂਸ਼ਿਤ ਹੋ ਰਿਹਾ ਹੈਗਾ ਫਿਰ ਜਿਹੜੀ ਵਪਾਰਵ ਵਪਾਰਕ ਬੰਦੇ ਸੀਗੇ ਉਹਨਾਂ ਨੇ ਪਾਣੀ ਨੂੰ ਪਹਿਲਾਂ ਟ੍ਰੀਟ ਕਰਨਾ ਸ਼ੁਰੂ ਕੀਤਾ ਨਵੀਂ ਟੈਕਨੋਲੋਜੀ ਦੇ ਨਾਲ ਉਹਦੇ ਨਾਲ ਜਿਹੜਾ ਹੈਗਾ ਆ ਪਾਣੀ ਟ੍ਰੀਟਮੈਂਟ ਤੋਂ ਬਾਅਦ ਹੀ ਨਹਿਰਾਂ ਦੇ ਵਿੱਚ ਜਦੋਂ ਤੱਕ ਸਫੀਸ਼ੀਐਂਟ ਕੁਆਲਿਟੀ ਤੱਕ ਨਹੀਂ ਪਹੁੰਚ ਜਾਂਦਾ ਉਸ ਤੋਂ ਬਗੈਰ ਉਹਨਾਂ ਨੂੰ ਨਹਿਰਾਂ ਦੇ ਵਿੱਚ ਡਿਸਪੋਜ ਆਫ ਨਹੀਂ ਕੀਤਾ ਜਾਂਦਾ ਇਹਦੇ ਨਾਲ ਜਿਹੜਾ ਹੈਗਾ ਆ ਇੱਕ ਤਾਂ ਸਸਟੈਨਬਿਲਿਟੀ ਵੀ ਸਾਨੂੰ ਮਿਲਦੀ ਹੈਗੀ ਹੈ ਵਾਤਾਵਰਣ ਵੀ ਦੂਸ਼ਿਤ ਹੋਣ ਤੋਂ ਬਚ ਜਾਂਦਾ ਹੈਗਾ ਇ ਇਹ ਤੋਂ ਇੱਕ ਗੱਲ ਹੋਰ ਵੀ ਨਿਕਲ ਕੇ ਆਉਂਦੀ ਹੈਗੀ ਹੈ ਕੋਈ ਵੀ ਜਿਹੜਾ ਹੈਗਾ ਆਪਣੀ ਮਨ ਮਰਜ਼ੀ ਦੇ ਨਾਲ ਕਿਸੇ ਵੀ ਜਗ੍ਹਾ ਦੇ ਉੱਤੇ ਜਾ ਕੇ ਗਲਤ ਤਰੀਕੇ ਨਾਲ ਆਪਣਾ ਕੰਮ ਨਹੀਂ ਕਰ ਸਕਦਾ ਧੰਨਵਾਦ ਜੀ